ਹਾਂਜੀ ਮੈਂ ਕਿਸੇ ਵੀ ਰੈਸਪੀ ਨੂੰ ਜਿਹੜੀ ਚੀਜ਼ ਨੂੰ ਬਣਾਉਣ ਲੱਗਿਆਂ ਉਹਦੀ ਰੈਸਪੀ ਦੀ ਬਿਲਕੁਲ ਪਾਲਣਾ ਕਰਦੀ ਹਾਂ ਕਿਉਂਕਿ ਜਿਹੜੀ ਇੱਕ ਰੈਸਪੀ ਹੁੰਦੀ ਹੈ ਉਹਦੇ ਕਰਕੇ ਹੀ ਜਿਹੜੀ ਚੀਜ਼ ਹੈ ਉਹ ਪ੍ਰੋਪਰ ਬਣਦੀ ਹੈ ਉਹਦਾ ਪ੍ਰੋਪਰ ਸਵਾਦ ਆਉਂਦਾ ਜਿਹਦੇ ਜੇ ਆਪਾਂ ਰੈਸਪੀ ਦੇ ਵਿੱਚ ਕੁਝ ਚੀਜ਼ਾਂ ਦੀ ਜਿਹੜੀ ਸਮੱਗਰੀ ਨੂੰ ਘਟਾ ਵਧਾ ਦਈਏ ਤਾਂ ਉਹ ਪ੍ਰੋਪਰ ਜਿਹੜਾ ਟੇਸਟ ਨਹੀਂ ਦਿੰਦੀ ਜਿਹਦੇ ਕਰਕੇ ਮੈਂ ਇਹ ਰੈਸਪੀ ਨੂੰ ਪ੍ਰੋਪਰ ਉੱਦਾਂ ਹੀ ਪਾਲਣਾ ਕਰਦੀ ਹਾਂ ਪਰ ਕਦੇ ਕਦੇ ਮੈਂ ਆਪਣੇ ਮਦਰ ਫਾਦਰ ਦਾਦਾ ਦਾਦੀ ਉਹ ਬੀ ਬੀ ਪੀ ਦੇ ਪੇਸ਼ੈਂਟ ਹੋਣ ਕਰਕੇ ਜਾਂ ਹਾਰਟ ਦੀ ਪ੍ਰੋਬਲਮ ਹੋਣ ਕਰਕੇ ਜਿੱਦਾਂ ਨਮਕ ਹੋ ਗਿਆ ਮਿਰਚ ਹੋ ਗਈ ਇਹਨਾਂ ਨੂੰ ਜਰੂਰ ਥੋੜ੍ਹਾ ਘਟਾ ਵਧਾ ਦਿੰਦੀ ਹਾਂ ਪਰ ਜਿਹੜੀ ਰੈਸਪੀ ਦੇ ਵਿੱਚ ਜੋ ਸਮੱਗਰੀ ਹੁੰਦੀ ਹੈ ਉਹਨੂੰ ਬਿਲਕੁਲ ਉੱਦਾਂ ਹੀ ਪਾਇਆ ਜਾਂਦਾ ਜਿੱਦਾਂ ਉਹ ਜਿੱਦਾਂ ਉਸਦੀ ਰੈਸਪੀ ਹੁੰਦੀ ਹੈ ਉਹਦੇ ਨਾਲ ਕੋਈ ਵੀ ਜਿਹੜੀ ਮਤਲਬ ਕਿ ਚੀਜ਼ ਨੂੰ ਇੱਧਰ ਉੱਧਰ ਨਹੀਂ ਕੀਤਾ ਜਾਂਦਾ ਕਿਉਂਕਿ ਇੱਕ ਰੇਐਸਪੀ ਦੇ ਵਿੱਚ ਹੀ ਜਿਹੜੀ ਚੀਜ਼ ਆ ਉਹਦਾ ਪ੍ਰੋਪਰ ਸਵਾਦ ਆਉਂਦਾ ਰੈਸਪੀ ਦੇ ਵਿੱਚ ਜੇ ਆਪਾਂ ਸਮੱਗਰੀ ਨੂੰ ਘੱਟ ਪਾਵਾਂਗੇ ਤਾਂ ਉਹ ਚੀਜ਼ ਹੈ ਜਿਹੜੀ ਪ੍ਰੋਪਰ ਟੇਸਟੀ ਨਹੀਂ ਬਣੇਗੀ